ਵਰਤਮਾਨ ਸਮੇਂ ਯੋਗਾ ਜਿਹੜਾ ਉਹ ਸਾਡੇ ਜੀਵਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਕਿਉਂਕਿ ਜਿਹੜੀ ਯੋਗਾ ਦੀ ਸ਼ੁਰੂਆਤ ਅਸੀਂ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਯੋਗਾ ਕਰਦੇ ਹਾਂ ਅਤੇ ਇਸ ਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਬਿਲਕੁਲ ਸ਼ਾਂਤ ਤਰੋ ਤਾਜ਼ਾ ਰਹਿੰਦਾ ਮਨ ਅਤੇ ਤਨ ਦੋਨਾਂ ਦੇ ਲਈ ਹੀ ਯੋਗਾ ਵਧੀਆ ਅਤੇ ਵੱਖ ਵੱਖ ਜਿਹੜੇ ਉਮਰ ਦੇ ਲੋਕ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਾ ਲਾਭ ਉਠਾ ਰਹੇ ਨੇ ਅੱਜ ਕੱਲ੍ਹ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਅੱਸੀ ਅੱਸੀ ਨੱਬੇ ਨੱਬੇ ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਯੋਗਾ ਕਰ ਕਰ ਕੇ ਯੋਗਾ ਦੇ ਜਿਹੜੇ ਵੱਖ ਵੱਖ ਪੜਾਅ ਨੇ ਉਹਨਾਂ ਨੂੰ ਧਾਰਨ ਕੀਤਾ ਉਹਨਾਂ ਨੂੰ ਅਪਣਾ ਕੇ ਕਿਸ ਤਰ੍ਹਾਂ ਉਹ ਜਿਹੜੇ ਇੰਨੀ ਵੱਡੀ ਉਮਰ ਦੇ ਵਿੱਚ ਵੀ ਫਿੱਟ ਰਹਿ ਰਹੇ ਨੇ ਅਤੇ ਸਾਡੇ ਜੀਵਨ ਦੇ ਵਿੱਚ ਜੇਕਰ ਅਸੀਂ ਐਕਸਰਸਾਈਜ਼ ਕਰਦੇ ਹਾਂ ਐਕਸਰਸਾਈਜ਼ ਦਾ ਨਾਂ ਹੀ ਯੋਗਾ ਹੈ ਅਤੇ ਐਕਸਰਸਾਈਜ਼ ਕਰਾਂਗੇ ਤਾਂ ਅਸੀਂ ਫਿਜ਼ੀਕਲੀ ਵੀ ਫਿੱਟ ਹਾਂ ਸਾਡਾ ਮਨ ਵੀ ਫਿੱਟ ਮਨ ਵੀ ਸਾਡਾ ਠੀਕ ਰਹੇਗਾ ਜੇ ਫਿਜ਼ੀਕਲੀ ਠੀਕ ਹਾਂ ਤਾਂ ਮਨ ਵੀ ਠੀਕ ਹੈ ਇਸ ਤਰ੍ਹਾਂ ਜਿਹੜਾ ਯੋਗਾ ਗਾ ਉਹ ਅੱਜ ਕੱਲ੍ਹ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਆ ਨਾ ਉਹਦੇ ਵਿੱਚ ਜਿਹੜਾ ਯੋਗਾ ਇਹ ਕਾਫੀ ਜਿਹੜਾ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ